ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ ਪਹਿਲੀ ਚੁਣੌਤੀ ਤਾਂ ਇਹ ਹੈ ਕਿ ਜਿ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਨ ਜਾਂ ਪੜ੍ਹ ਚੁੱਕੇ ਹਨ ਉਹਨਾਂ ਦੇ ਲਈ ਕੁਝ ਸ਼ਬਦਾਂ ਦਾ ਮਹੱਤ ਮਤਲਬ ਕੱਢਣਾ ਬਹੁਤ ਹੀ ਔਖਾ ਹੈ ਅੱਜ ਦੀ ਤਰੀਕ ਵਿੱਚ ਜੇ ਅਸੀਂ ਉਹਨਾਂ ਨੂੰ ਕੁਛ ਪੰਜਾਬੀ ਦੇ ਵਿੱਚ ਬੋਲਦੇ ਹਾਂ ਤਾਂ ਉਹਨਾਂ ਨੂੰ ਸਿੱਧੇ ਸਿੱਧੇ ਤਰੀਕੇ ਨਾਲ ਨਹੀਂ ਸਮਝ ਆਉਂਦਾ ਅਤੇ ਸਮਝ ਕਦੋਂ ਆਉਂਦਾ ਹੈ ਜਦੋਂ ਅਸੀਂ ਉਹ ਇੱਕ ਸ਼ਬਦ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਦੇ ਹਾਂ ਕਿ ਇਹਦਾ ਆਹ ਮਤਲਬ ਆ ਦੂਜੀ ਚੁਣੌਤੀ ਇਹ ਹੈ ਕਿ ਜਿਹੜੀ ਅੱਜ ਦੀ ਸਾਡੀ ਪੀੜੀ ਹੈ ਉਹ ਬਾਹਰ ਜਾਣਾ ਚਾਹੁੰਦੀ ਹੈ ਅਤੇ ਬੇਸ਼ੱਕ ਹੈ ਬੇਸ਼ੱਕ ਉਹ ਪੰਜਾਬੀ ਬੋਲਦੇ ਹਨ ਬਟ ਪੰਜਾਬੀ ਬਟ ਬਾਹਰ ਜਾਣ ਦੇ ਲਈ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਅਪਣਾਉਣਾ ਪੈਂਦਾ ਹੈ ਅਤੇ ਜਿਸ ਕਰਕੇ ਪੰਜਾਬੀ ਭਾਸ਼ਾ ਦਾ ਬਹੁਤ ਜ਼ਿਆਦਾ ਅਪਮਾਨ ਹੋ ਰਿਹਾ ਉਹਨਾਂ ਨੂੰ ਦੁਰਕਾਰਨੀ ਪੈਂਦੀ ਹੈ ਨਾ ਚਾਹੁੰਦੇ ਹੋਇਆਂ ਵੀ ਤੀਜੀ ਚੁਣੌਤੀ ਇਹ ਹੈ ਕਿ ਜਿਹੜੇ ਤਾਂ ਮਾਂ ਪਿਓ ਆਪ ਪੰਜਾਬੀ ਬੋਲਦੇ ਹਨ ਪਰ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਨੂੰ ਕੋਨਵੈਂਟ ਸਕੂਲਾਂ ਵਿੱਚ ਹੀ ਪਾੜਨ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਨਾ ਕਿ ਉਹਨਾਂ ਨੂੰ ਸਰਕਾਰੀ ਅਤੇ ਪੰਜਾਬੀ ਸਕੂਲ ਦੇ ਵਿੱਚ ਪੜ੍ਹਾਇਆ ਜਾਵੇ ਅਤੇ ਚ ਚੌਥੀ ਅਤੇ ਸਭ ਤੋਂ ਅਹਿਮ ਚੁਣੌਤੀ ਇਹ ਹੈ ਕਿ ਜੋ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਡੇ ਦਸਾਂ ਗੁਰੂਆਂ ਨੇ ਆਪਣੀ ਬਾਣੀ ਗੁਰਮੁਖੀ ਲਿਪੀ ਪੰਜਾਬੀ ਦੇ ਵਿੱਚ ਉਹਨਾਂ ਦੇ ਵਿੱਚ ਰਚਿਤ ਕੀਤੀ ਗਈ ਹੈ ਤਾਂ ਅੱਜ ਦੀ ਪੀੜੀ ਜੋ ਅੱਜ ਦੀ ਤਰੀਕ ਤੱਕ ਪੀੜੀ ਹੈ ਉਹ ਦਾ ਉਸਨੂੰ ਪੜ੍ਹ ਪਾਵੇਗੀ ਪਰ ਜੇਕਰ ਆਉਣ ਵਾਲੀ ਪੀੜੀ ਦੀ ਗੱਲ ਕੀਤੀ ਜਾਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਾ ਹੀ ਪੜ੍ਹ ਪਾਉਗੀ ਚ ਨਾ ਹੀ ਨਹੀਂ ਹੀ ਪੜ੍ਹ ਪਾਊਗੀ